ਹੈਲੋ ਹਾਂਜੀ ਸਰਦਾਰ ਸੁਰਿੰਦਰ ਸਿੰਘ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ ਬਸ ਜੀ ਆਪਣਾ ਤਾਂ ਕਾਰੋਬਾਰ ਏ ਖੇਤੀ ਦਾ ਹੁਣ ਆਪਾਂ ਤਾਂ ਖੇਤੀ ਦੇ ਵਿੱਚ ਲੱਗੇ ਹੋਏ ਹਾਂ ਹਾਂਜੀ ਅਸੀਂ ਬਹੁਤ ਬੜਾ ਅਸਰ ਹੋ ਰਿਹਾ ਜੀ ਜਲਦੀ ਗਰਮੀ

ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਘੱਟਗੇ ਬੜਾ ਅਸਰ ਹੋਇਆ ਇਹ ਗਲੋਬਲ ਵਾਰਮਿੰਗ ਦਾ ਇਹਦਾ ਹਾਂਜੀ ਹਾਂਜੀ ਮੈਂ ਵੀ ਇਹੀ ਚਾਹੁੰਦਾ ਬਾਕੀ ਸਰਕਾਰ ਵੱਲੋਂ ਵੀ ਬੜੇ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਪਿੰਡ ਪਿੰਡ ਜਾ ਕੇ ਦੱਸਿਆ ਜਾ ਰਿਹਾ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵੀ ਤੁਸੀਂ ਪਰਾਲੀ ਨਾ ਜਾਲੋ ਹੈ ਨਾ ਅਤੇ ਇੱਦਾਂ ਦੇ ਕੁਝ ਜਿਹੜੇ ਹੈਗੇ ਨੇ ਉਹ ਉਪਾਅ ਆਪਾਂ ਕਰ ਸਕਦੇ ਆ ਪਿੰਡ ਪੱਧਰ ਤੋਂ ਲੈ ਕੇ ਏ ਜ਼ਿਆਦਾ ਆਪਣੇ ਹਾਂਜੀ ਉਹਦੇ ਨਾਲ ਵੀ ਆਪਾਂ ਨੂੰ ਬਹੁਤ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪਰ ਆਪਾਂ ਵੀ ਕਰ ਸਕਦੇ ਹਾਂ ਹਾਂਜੀ ਉਸ ਤੋਂ ਬਿਨਾਂ ਜਿਵੇਂ ਜਿਹੜਾ ਜਿਸ ਤਰਾਂ ਬਾਕੀ ਚੀਜ਼ਾਂ ਇਫੈਕਟ ਕਰ ਰਹੀਆਂ ਨੇ ਕਾਫੀ ਜਿਵੇਂ ਇੰਡਸਟਰੀ ਹੋ ਗਈ ਹਾਂਜੀ

ਹਾਂਜੀ ਜਿਹੜੇ ਇੰਟਰਨੈਸ਼ਨਲ ਵਾਰ ਚੱਲ ਰਹੀ ਹੈ ਸਾਲ ਡੇਢ ਸਾਲ ਤੋਂ ਹਾਂਜੀ ਪਰਾਲੀ ਹਾਂ ਪਰਾਲੀ ਜਾਨੀ ਮੇਨ ਮੁੱਦਾ ਹੈਗਾ ਜਿਵੇਂ ਇਹਨੂੰ ਕਰਨ ਦਾ ਉਸਤੇ ਰੋਕ ਲਗਾ ਸਕਦੇ ਆ

ਹਾਂਜੀ ਸਰਕਾਰ ਹਾਂਜੀ ਉਹਨਾਂ ਦੇ ਸਬਸਿਡੀ ਵੀ ਹੈਗੀ ਉਹਨਾਂ ਦੇ ਉੱਪਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਪਿੰਡ ਬਿਲਕੁਲ ਬਿਲਕੁਲ ਬਿਲਕੁਲ ਬੜੀ ਸੋਹਣੀ ਸੋਚ ਆ ਤੁਹਾਡੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ